ਹਾਂਜੀ ਸਾਨੂੰ ਖਾਣ ਪਕਵਾਉਣ ਦੀ ਆਫਤ ਆਈ ਹੈ ਜਦੋਂ ਵੀ ਅਚਾਨਕ ਕੋਈ ਘਰ ਰਿਸ਼ਤੇਦਾਰ ਆ ਜਾਂਦਾ ਹੈ ਅਤੇ ਸਾਨੂੰ ਕਈ ਵਾਰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਖਾਣਾ ਕਈ ਵਾਰ ਨਹੀਂ ਬਣਾਇਆ ਹੁੰਦਾ ਅਤੇ ਉਹਦੇ ਵਿੱਚ ਸਾਨੂੰ ਜਲਦੀ ਜਲਦੀ 'ਚ ਖਾਣਾ ਬਣਾਉਣਾ ਪੈਂਦਾ ਹੈ ਅਤੇ ਬਹੁਤ ਜ਼ਿਆਦਾ ਆਫਤ ਆਉਂਦੀ ਹੈ ਅਤੇ ਹੁਣ ਫੇਰ ਅਸੀਂ ਸਵੇਰੇ ਵੀ ਸਬਜ਼ੀ ਬਣਾ ਲੈਂਦੇ ਏ ਅਤੇ ਸਬਜ਼ੀ ਬਣਾ ਲੈਂਦੇ ਆ ਸਬਜ਼ੀ ਬਣਾ ਕੇ ਰੱਖ ਲੈਂਦੇ ਆ ਅਤੇ ਥੋੜ੍ਹਾ ਆਪਣਾ ਜਿਹੜਾ ਇਹ ਆਪਣਾ ਰਿਸ਼ਤੇਦਾਰਾਂ ਕੋਲ ਵੀ ਟਾਈਮ ਆਪਣਾ ਬੈਠਦੇ ਨੇ ਅਤੇ ਫਿਰ ਉਹਨਾਂ ਨੂੰ ਖਾ ਪੀ ਕੇ ਅਸੀਂ ਉਹ ਕਰਦੇ ਨੇ ਅਤੇ ਉਹ ਆਫਤ ਨੂੰ ਅਸੀਂ ਐਵੇਂ ਠੀਕ ਕਰਿਆ ਵੀ ਜਦੋਂ ਵੀ ਕੋਈ ਰਿਸ਼ਤੇਦਾਰ ਆਉਂਦਾ ਏ ਤਾਂ ਅਸੀਂ ਆਪਣਾ ਖਾਣ ਦਾ ਏ ਜਿਹੜਾ ਉਹ ਪਕਵਾਨ ਬਣਾ ਦਿੰਦੇ ਹੈ ਆਉਣ ਤੋਂ ਪਹਿਲਾਂ ਥੋੜ੍ਹਾ ਟਾਈਮ ਪਹਿਲੇ ਜ਼ਿਆਦਾ ਨਹੀਂ ਅਤੇ ਥੋੜ੍ਹਾ ਟਾਈਮ ਪਹਿਲਾਂ ਇਹ ਬਣਾ ਦਿੰਦੇ ਆ ਜਿਸ ਕਰਕੇ ਸਾਨੂੰ ਜਲਦੀ ਆਫਤ ਨਹੀਂ ਆਉਂਦੀ ਅਤੇ ਅਸੀਂ ਥੋੜ੍ਹਾ ਟਾਈਮ ਬੈਠ ਵੀ ਜਾਂਦੇ ਹੈ ਅਤੇ ਜਿਹੜੀ ਆਫਤ ਆਉਂਦੀ ਏ ਪਕਾਉਣ ਵਾਲ਼ੀ ਉਹ ਸਾਡੀ ਥੋੜ੍ਹੀ ਜਿਹੀ ਠੀਕ ਹੋ ਚੁੱਕੀ ਹੈ